ਸਾਡੇ ਪਿੰਡ ਵਿੱਚ ਨੌਜਵਾਨ ਹਾਲੀ ਸਾਲ ਦੇ ਲੋਕ ਨਾਚ ਵਿੱਚ ਵਧੇਰੀ ਦਿਲਚਸਪੀ ਰੱਖਦੇ ਹਨ ਅਤੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਭੰਗੜਾ ਭੰਗੜਾ ਟੀਮ ਕਰਦੇ ਹਾਂ ਅਤੇ ਸਾਡੇ ਪਿੰਡ ਵਿੱਚ ਭੰਗੜਾ ਕਲੱਬ ਵੀ ਬਣਿਆ ਜਿੱਥੇ ਨੌਜਵਾਨਾਂ ਨੂੰ ਭੰਗੜਾ ਸਿਖਾਇਆ ਜਾਂਦਾ ਅਤੇ ਉਹ ਅੱਗੇ ਜਾ ਕੇ ਪਾਰਟੀਸਪੇਟ ਕਰਦੇ ਹਨ ਅਤੇ ਕੋਪੀਟੀਸ਼ਨ ਜਿੱਤ ਕੇ ਲੈ ਕੇ ਆਉਂਦੇ ਹਨ ਭੰਗੜਾ ਪੰਜਾਬ ਦੇ ਦੋ ਮੁੱਖਾਂ ਅਤੇ ਉੱਘੇ ਲੋਕ ਨਾਚ ਵਿੱਚ ਇੱਕ ਹੈ ਦੂਜਾ ਲੋ ਦੂਜਾ ਮੁੱਖ ਨਾਚ ਗਿੱਧਾ ਹੈ ਅਤੇ ਭੰਗੜਾ ਗੱਭਰੂਆਂ ਦਾ ਨਾਚ ਹੈ ਜਦ ਕਿ ਗਿੱਧਾ ਮੁਟਿਆਰਾਂ ਦਾ ਨਾਚ ਹੈ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਨੱਚਿਆ ਜਾਂਦਾ ਹੈ ਜਿਹਨਾਂ ਨੂੰ ਤਕਰੀਬਨ ਬਹੁਤ ਜ਼ਿਆਦਾ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਇਹ ਕਣਕ ਦੀ ਵਾਢੀ ਵਿਸਾਖੀ ਮੇਲੇ ਵਿਆਹਾਂ ਤਿਥ ਤਿਉਹਾਰਾਂ ਮੰਗਣੇ ਆਦਿ ਵਿੱਚ ਪਾਇਆ ਜਾਂਦਾ ਹੈ ਲੋਕ ਨਾਚ ਦੇ ਕਿਸਾਨੀ ਸੰਸਕ੍ਰਿਤੀ ਵਿੱਚ ਪ੍ਰਚੱਲਿਤ ਹੈ ਲੋਕ ਧਾਰਾ ਵਿਗਿਆਨੀ ਸੁਭਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦ ਵਿੱਚ ਪਹਿਲੇ ਪਹਿਲੇ ਜਦੋਂ ਪੰਜਾਬੀਆਂ ਨੇ ਹਰੀ ਫਸਲ ਨੂੰ ਸੁਨਿਹਰਾ ਸਿੱਟਾ ਕਰਦੇ ਹੋਏ ਵੇਖਿਆ ਤਾਂ ਹੁਲਾਰੇ ਨਾਲ ਉਹਨਾਂ ਦਾ ਮਨ ਨੱਚ ਉੱਠਿਆ ਸੀ ਅਤੇ ਲੰਮੀਆਂ ਆਉਣ ਕੜੀ ਮਿਹਨਤ ਨੂੰ ਸੁਨਹਿਰੀ ਫਲ ਲੱਗੇ ਵੇਖ ਕੇ ਕਿਸੇ ਦਾ ਦਿਲ ਨਹੀਂ ਨੱਚ ਉੱਠਦਾ ਮੁੱਢ ਵਿੱਚ ਇਹ ਨਾਚ ਫਸਲਾਂ ਲਈ ਉਪਜਾਊ ਸ਼ਕਤੀ ਬਣਾਉਣ ਲਈ ਕੀਤੀਆਂ ਰੀਤੀ ਰਸਮਾਂ ਨੂੰ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਹਨ ਅਤੇ ਇਹ ਸਾਡੇ ਨੌਜਵਾਨ ਬਹੁਤ ਹੀ ਜ਼ਿਆਦਾ ਦਿਲਚਸਪੀ ਰੱਖਦੇ ਹਨ ਬਹੁਤ ਜ਼ਿਆਦਾ ਉਹਨਾਂ ਨੂੰ ਖੁਸ਼ੀ ਮਿਲਦੀ ਹੈਗੀ ਸਾਡੇ ਪਿੰਡ ਵਿੱਚ ਇੱਕ ਭੰਗੜਾ ਕਲੱਬ ਬਣਿਆ ਉੱਥੇ ਸ਼ਾਮ ਵੇਲੇ ਸਵੇਰ ਵੇਲੇ ਜਾਂਦੇ ਹਨ ਆਪਣੇ ਭੰਗੜੇ ਦੀ ਤਿਆਰੀ ਕਰਦੇ ਹਨ ਅਤੇ ਉਹਨਾਂ ਵਿੱਚ ਜਿਹੜੇ ਟੀਚਰ ਹੁੰਦੇ ਹਨ ਉਹ ਉਹਨਾਂ ਨੂੰ ਅੱਗੇ ਪਾਰਟੀਸਪੇਟ ਕਰਨ ਵਿੱਚ ਵੀ ਸਹਾਇਤਾ ਕਰਦੇ ਹਨ ਅਤੇ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਇਹ ਭੰਗੜਾ ਨੌਜਵਾਨ ਪਾਰਟੀਸਪੇਟ ਕਰਕੇ ਜਿੱਤ ਕੇ ਕੰਪੀਟੀਸ਼ਨ ਨੂੰ ਆਉਂਦੇ ਹਨ ਅਤੇ ਆਪਣੇ ਹੱਥ ਵਿੱਚ ਮੈਡਲ ਟਰੋਫੀਆਂ ਲੈ ਕੇ ਆਉਂਦੇ ਹਨ ਤਾਂ ਉਹਨਾਂ ਦੇ ਜੋ ਭੰਗੜਾ ਸਿਖਾਉਂਦੇ ਹਨ ਜੋ ਉਹਨਾਂ ਦੇ ਟੀਚਰ ਹੁੰਦੇ ਹਨ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਇਸ ਨਾਲ ਸਾਡੇ ਪਿੰਡ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਰਹਿੰਦਾ